ਭਾਅ ਜੀ ਮੈਂ ਤੁਸੀਂ ਟੂਰਿਸਟ ਗਾਈਡ ਬੋਲ ਰਹੇ ਨਾ ਤੁਹਾਡੇ ਨਾਲ ਗੱਲ ਕੀਤੀ ਸੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਮਤਲਬ ਦੱਸਿਆ ਸੀ ਘੁੰਮਾ ਦਓਗੇ ਸਾਨੂੰ ਹਾਂਜੀ ਹਾਂਜੀ ਭਾਅ ਜੀ ਅਸੀਂ ਆਉਣ ਲੱਗੇ ਹਾਂ ਅਤੇ ਪੁੱਛਣਾ ਸੀ ਤੁਸੀਂ ਮਤਲਬ ਕਿਹੜੀ ਕਿਹੜੀ ਜਗ੍ਹਾ ਸਾਨੂੰ ਘੁੰਮਾਓਗੇ ਇੱਧਰ ਗੁਰਦਾਸਪੁਰ ਸਾਈਡ ਅਸੀਂ ਬਟਾਲੇ ਪਹੁੰਚ ਗਏ ਬਸ ਲੱਗ ਜਾਣਾ ਅੱਧਾ ਘੰਟਾ ਹਾਂਜੀ ਹਾਂਜੀ

ਠੀਕ ਠੀਕ ਹੈ

ਇੱਕ ਹੋ ਗਿਆ ਫਿਸ਼ ਪਾਰਕ ਉਸ ਤੋਂ ਬਾਅਦ ਉਸ ਤੋਂ ਬਾਅਦ ਦੂਸਰੀ ਜਗ੍ਹਾ

ਠੀਕ ਹੈ ਘੱਲੂਘਾਰੇ ਹਾਂਜੀ ਪੰਡੋਰੀ ਧਾਮ ਹੋ ਗਿਆ ਹਾਂਜੀ ਪੰਡੋਰੀ ਧਾਮ ਬਾਰੇ ਤਾਂ ਸੁਣੀ ਦਾ ਹੈ ਅਸੀਂ ਲੋਕਾਂ ਤੋਂ ਠੀਕ ਹੈ ਭਾਅ ਜੀ ਠੀਕ ਠੀਕ ਹੈ ਭਾਅ ਜੀ ਠੀਕ ਹੈ ਭਾਜੀ ਓਕੇ